ਹਾਂਜੀ ਭਾਅ ਜੀ ਜਿਹੜੇ ਇਹ ਕਿਰਾਏ ਦੇ ਪੈਸੇ ਆ ਇਹ ਸਾਡੇ ਕੋਲ ਔਨਲਾਈਨ ਨਹੀਂ ਹੈਗੇ ਅਸੀਂ ਤੁਹਾਨੂੰ ਨਕਦ ਪੈਸੇ ਦਿਆਂਗੇ ਅਤੇ ਕਿਉਂਕਿ ਸਾਡੇ ਕੋਲ ਔਨਲਾਈਨ ਪੈਸੇ ਨਹੀਂ ਹੁੰਦੇ ਅਤੇ ਨਾ ਅਸੀਂ ਇਹ ਔਨਲਾਈਨ ਵਰਤਦੇ ਹਾਂ ਅਤੇ ਸਾਡੀ ਤੁਹਾਡੇ ਮਾਲਕ ਨਾਲ ਗੱਲ ਹੋਈ ਸੀ ਉਨ੍ਹਾਂ ਕਿਹਾ ਮਾਲਕ ਨਾਲ ਗੱਲ ਹੋਈ ਸੀ ਉਨ੍ਹਾਂ ਨੇ ਕਿਹਾ ਸੀ ਕਿ ਤੁਸੀਂ ਆਪਣੇ ਡਰਾਈਵਰ ਨੂੰ ਪਹੁੰਚਣ ਤੋਂ ਬਾਅਦ ਉੱਥੇ ਪੈਸੇ ਦੇ ਦਿਓ ਅਤੇ ਇਸ ਲਈ ਅਸੀਂ ਤੁਹਾਨੂੰ ਨਗਦ ਪੈਸੇ ਦੇ ਸਕਦੇ ਹਾਂ ਹਾਂਜੀ ਅਤੇ ਕਿਉਂਕਿ ਔਨਲਾਈਨ ਪੈਸੇ ਨਹੀਂ ਹੁੰਦੇ ਸਾਡੇ ਕੋਲ ਨਾ ਹੀ ਅਸੀਂ ਔਨਲਾਈਨ ਐਪ ਵਰਤਦੇ ਹਾਂ ਅਤੇ ਨਹੀਂ ਤਾਂ ਤੁਸੀਂ ਪੁੱਛ ਲਓ ਤੁਸੀਂ ਗੱਲ ਕਰਨੀ ਕਿਸੇ ਨਾਲ ਕਰ ਲਓ ਲੇਕਿਨ ਅਸੀਂ ਪੈਸੇ ਤੁਹਾਨੂੰ ਨਕਦ ਹੀ ਦੇ ਸਕਦੇ ਹਾਂ ਔਨਲਾਈਨ ਪੈਸੇ ਨਹੀਂ ਹੈਗੇ ਸਾਡੇ ਕੋਲ ਬਲਕਿ ਕੈਸ਼ ਹੀ ਪੈਸੇ ਹੈਗੇ ਆ ਅਤੇ ਕੈਸ਼ ਈ ਅਸੀਂ ਦੇ ਸਕਦੇ ਹਾਂ ਤੁਸੀਂ ਕਿ ਮਤਲਬ ਕਿ ਕਿੱਦਾਂ ਕਰੋਗੇ ਕੈਸ਼ ਪੈਸੇ ਲੈਣੇ ਨਾ ਸਾਡੇ ਕੋਲੋਂ ਲੈ ਲਓ ਨਕਦ ਪੈਸੇ ਲੈ ਲਓ ਹਾਂਜੀ ਠੀਕ ਹੈ ਜੀ